ਸਾਡੇ ਪਿੰਡ ਵਿੱਚ ਆਮ ਕੀਤੇ ਜਾਣ ਵਾਲੇ ਕਾਰੋਬਾਰ ਵਿੱਚ ਸ਼ਾਮਲ ਹਨ ਖੇਤੀਬਾੜੀ ਪਸ਼ੂ ਪਾਲਣ ਦੁੱਧ ਡੇਅਰੀ ਕਰਿਆਨੇ ਕੱਪੜੇ ਅਤੇ ਜੁੱਤੇ ਦੀਆਂ ਦੁਕਾਨਾਂ ਆਦਿ ਪਿੰਡ ਦੇ ਜ਼ਿਆਦਾਤਰ ਲੋਕ ਖੇਤੀਬਾੜੀ ਵਿੱਚ ਰੁੱਝੇ ਹੋਏ ਹਨ ਪ੍ਰੰਤੂ ਆਮਦਨ ਘੱਟ ਹੋਣ ਕਾਰਨ ਪਿੰਡ ਦੇ ਸਰਪੰਚ ਨੇ ਕਿਸਾਨਾਂ ਨਾਲ ਅਤੇ ਪਸ਼ੂ ਪਾਲਣਾ ਨਾਲ ਮਿਲ ਕੇ ਵਰਮੀ ਕੰਪੋਸਟਿੰਗ ਭਾਵ ਕੀੜਿਆਂ ਦੀ ਕਾਸ਼ਤ ਜਾਂ ਕੇਚੂਆ ਖਾਦ ਬਣਾਉਣ ਦੀ ਸਲਾਹ ਦਿੱਤੀ ਇਹ ਇੱਕ ਲਾਭਕਾਰੀ ਕਾਰੋਬਾਰ ਬਣ ਗਿਆ ਹੈ ਕੇਚੂਆ ਖਾਦ ਦਾ ਇਸਤੇਮਾਲ ਖੇਤੀਬਾੜੀ ਨੂੰ ਔਰਗੈਨਿਕ ਬਣਾਉਣ ਵਿੱਚ ਮਦਦ ਕਰਦਾ ਹੈ ਕਿਉਂਕਿ ਇਸ ਵਿਚ ਐਨ ਪੀ ਕੇ ਦੀ ਵਧੀਆ ਮਾਤਰਾ ਹੋਣ ਕਾਰਨ ਬੂਟੇ ਅਤੇ ਕਿਸਾਨਾਂ ਦੇ ਲਈ ਕਾਮਯਾਬ ਹੁੰਦਾ ਹੈ ਇਸ ਦੀ ਵਰਤੋਂ ਖੇਤੀਬਾੜੀ ਵਿੱਚ ਕੀਤੀ ਜਾਂਦੀ ਹੈ ਅਤੇ ਇਸ ਦੀ ਵਰਤੋਂ ਬੂਟੇ ਲਗਾਉਣ ਵਾਲੀਆਂ ਨਰਸਰੀਆਂ ਵਿੱਚ ਇਸ ਦਾ ਉਪਯੋਗ ਕੀਤਾ ਜਾਂਦਾ ਹੈ ਇਸ ਕਰਕੇ ਇਸ ਦੀ ਵਰਤੋਂ ਜ਼ਿਆਦਾ ਹੋਣ ਨਾਲ ਇਹ ਇਕ ਲਾਭਦਾਇਕ ਕਾਰੋਬਾਰ ਹੈ ਇਸ ਵਿੱਚ ਤਿਆਰ ਹੋਣ ਵਾਲੇ ਕੇਚੂਏ ਕੀੜੇ ਦੀ ਵਰਤੋਂ ਨਾਲ ਗੋਬਰਾਂ ਦੇ ਨਾਲ ਵਰਮੀ ਕੰਪੋਸਟਿੰਗ ਬਣਾਈ ਜਾਂਦੀ ਹੈ ਇਸ ਨੂੰ ਸੁਕਾ ਕੇ ਪੈਕਟਾਂ ਵਿੱਚ ਬੰਨ ਕੇ ਵੇਚਿਆ ਜਾਂਦਾ ਹੈ ਇਹ ਇੱਕ ਲਾਭਕਾਰੀ ਕਾਰੋਬਾਰ ਹੈ ਜਿਸ ਨਾਲ ਪਿੰਡਾਂ ਵਿੱਚ ਰਹਿਣ ਵਾਲੇ ਘਰ ਬਾਰ ਵਾਲੇ ਕਿਸਾਨ ਪਸ਼ੂ ਪਾਲਣ ਵਾਲੇ ਲੋਕਾਂ ਦੀ ਆਮਦਨ ਵਧਦੀ ਹੈ